ਹਾਂ ਅੱਜ ਤੁਹਾਡੇ ਨਾਲ ਮੈਂ ਆਪਣੀ ਭੰਗੜਾ ਐਰੋਬਿਕਸ ਕਲਾਸਾਂ ਬਾਰੇ ਵਿਚਾਰ ਸਾਂਝੇ ਕਰਨ ਲੱਗੀ ਹਾਂ ਭੰਗੜਾ ਐਰੋਬਿਕਸ ਭੰਗੜੇ ਦੀ ਹੀ ਇੱਕ ਕਿਸਮ ਹੈ ਜੋ ਕਿ ਸਰੀਰ ਦੀ ਕਸਰਤ ਲਈ ਬਹੁਤ ਹੀ ਵਧੀਆ ਤਰੀਕਾ ਹੈ ਇਸ ਨਾਲ ਸਰੀਰ ਨੂੰ ਬਹੁਤ ਫਾਇਦੇ ਮ ਫਾਇਦੇ ਮਿਲਦੇ ਹਨ ਭੰਗੜਾ ਐਰੋਬਿਕਸ ਸਰੀਰ ਕਸਰਤ ਦਾ ਹੀ ਸਰੋਤ ਹੈ ਮੈਂ ਇੱਕ ਕਹਾਣੀ ਸਾਂਝੀ ਕਰ ਸਕਦੀ ਹਾਂ ਕਿ ਕਿਵੇਂ ਭੰਗੜਾ ਐਰੋਬਿਕਸ ਨੇ ਕਿਵੇਂ ਮੇਰੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਮੇਰਾ ਨਾਮ ਸੁਖਵਿੰਦਰ ਕੌਰ ਹੈ ਮੈਂ ਅਕਸਰ ਹੀ ਆਪਣੇ ਵੱਧਦੇ ਭਾਰ ਕਰਕੇ ਚਿੰਤਾ ਵਿੱਚ ਰਹਿੰਦੀ ਸੀ ਮੈਂ ਭਾਰ ਘੱਟ ਕਰਨ ਲਈ ਕਈ ਸਾਲਾਂ ਤੱਕ ਸੰਘਰਸ਼ ਕਰਨ ਤੋਂ ਬਾਅਦ ਇੱਕ ਕੋਚਿੰਗ ਸੈਂਟਰ ਵਿੱਚ ਭੰਗੜਾ ਐਰੋਬਿਕਸ ਦੀ ਜੁਆਇਨ ਕੀਤਾ ਇਹ ਕੋਚਿੰਗ ਸੈਂਟਰ ਮੇਰੇ ਬਰਨਾਲਾ ਸ਼ਹਿਰ ਵਿੱਚ ਹੀ ਸੀ ਮੈਂ ਇੱਕ ਇਸ ਕੋਚਿੰਗ ਬਾਰੇ ਬਹੁਤ ਸੁਣਿਆ ਸੀ ਮੈਂ ਇਸ ਦੇ ਬਾਰੇ ਜਾਨਣ ਲਈ ਇਸ ਨੂੰ ਜੁਆਇਨ ਕਰਨ ਦੀ ਇੱਛਾ ਪ੍ਰਗਟਾਈ ਹੈ ਅਤੇ ਮੈਂ ਇਹਨਾਂ ਕਲਾਸਾਂ ਵਿੱਚ ਜੁਆਇਨ ਕੀਤਾ ਮੈਂ ਕੋਚ ਦਾ ਨਾਂ ਮੇਰੇ ਕੋਚ ਦਾ ਨਾਮ ਹਰਦੀਪ ਸਿੰਘ ਸੀ ਉਸ ਨੇ ਸ਼ੁਰੂਆਤ ਤੋਂ ਹੀ ਮੇਰਾ ਬਹੁਤ ਸਾਥ ਦਿੱਤਾ ਮੈਂ ਸ਼ੁਰੂ ਵਿੱਚ ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਮੈਂ ਰੋਜ਼ਾਨਾ ਆਉਣਾ ਸ਼ੁਰੂ ਕੀਤਾ ਮੈਨੂੰ ਨਹੀਂ ਪਤਾ ਸੀ ਕਿ ਭੰਗੜਾ ਐਰੋਬਿਕਸ ਐਰੋਬਿਕਸ ਦੇ ਅੱਗੇ ਜਾ ਕੇ ਇੰਨੇ ਸਾਰੇ ਫਾਇਦੇ ਮਿਲ ਸਕਦੇ ਹਨ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਦੇਖਦੀ ਰਹਿੰਦੀ ਅਤੇ ਉਹਨਾਂ ਤੋਂ ਵੀ ਸਿੱਖਣ ਦੀ ਕੋਸ਼ਿਸ਼ ਕਰਦੀ ਜਿਵੇਂ ਜਿਵੇਂ ਦਿਨ ਨਿਪਟਦੇ ਗਏ ਮੈਨੂੰ ਇਸ ਬਾਰੇ ਸਮਝ ਆਉਣ ਲਈ ਆਉਣ ਲਈ ਗਈ ਹੈਰਾਨੀ ਦੀ ਗੱਲ ਹੈ ਕਿ ਭੰਗੜਾ ਐਰੋਬਿਕਸ ਐਰੋਬਿਕਸ ਨੇ ਨਾ ਸਿਰਫ ਕਸਰਤ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਪ੍ਰਦਾਨ ਕੀਤਾ ਸਗੋਂ ਇਸ ਦੇ ਨੇ ਤੰਦਰੁਸਤੀ ਲਈ ਮੇਰੇ ਜਨਮ ਨੂੰ ਵੀ ਮੁੜ ਸੁਰਜੀਤ ਕੀਤਾ ਜਿਵੇਂ ਹੀ ਮੈਂ ਕਲਾਸਾਂ ਵਿੱਚ ਜਾਣਾ ਜਾਰੀ ਰੱਖਿਆ ਉੱਥੇ ਮੇਰੀ ਸਹਿਨਸ਼ੀਲਤਾ ਲਚਕਤਾ ਅਤੇ ਸਮੁੱਚੀ ਤੰਦਰੁਸਤੀ ਵਿੱਚ ਵਿੱਚ ਮਹੱਤਵਪੂਰਨ ਸੁਧਾਰ ਦੇਖਿਆ ਮੈਨੂੰ ਭਾਈਚਾਰੇ ਅਤੇ ਅਨੰਦ ਦੀ ਇੱਕ ਨਵੀਂ ਭਾਵਨਾ ਮਿਲੀ ਮੈਂ ਸਾਥੀ ਭਾਗੀਦਾਰਾਂ ਨਾਲ ਨਜ਼ਦੀਕੀ ਦੋਸਤੀ ਵਿਕਸਿਤ ਕੀਤੀ ਜਿਸ ਦੇ ਨੇ ਮੈਨੂੰ ਤੰਦਰੁਸਤੀ ਟੀਚਿਆਂ ਪ੍ਰਤੀ ਵਚਨਬੱਧ ਰਹਿਣ ਲਈ ਹੋਰ ਉਤਸ਼ਾਹਿਤ ਕੀਤਾ ਪਵਿੱਤਰ ਪਰਿਵਰਤਨ ਡੂੰਘਾ ਸੀ ਪਰ ਮੈਂ ਨਾ ਸਿਰਫ ਆਪਣਾ ਲੋੜੀਂਦਾ ਫਿਟਨੈਸ ਪੱਧਰ ਹਾਸਲ ਕੀਤਾ ਸਗੋਂ ਇਕ ਸਾ ਸਿਹਤਮੰਦ ਮਾਨਸਿਕਤਾ ਵੀ ਹਾਸਿਲ ਕੀਤੀ ਭੰਗੜਾ ਐਰੋਬਿਕਸ ਮੇਰੇ ਲਈ ਸਿਰਫ ਇੱਕ ਕਸਰਤ ਨਹੀਂ ਬਣ ਗਿਆ ਇਹ ਜੀਵਨ ਅਤੇ ਜੀਵਨ ਸ਼ਕਤੀ ਦਾ ਜਸ਼ਨ ਬਣ ਗਿਆ ਸੱਭਿਆਚਾਰ ਵਿਰਾਸਤ ਨੂੰ ਨਿੱਜੀ ਸਿਹਤ ਦੇ ਨਾਲ ਇਸ ਤਰੀਕੇ ਨਾਲ ਮਿਲਦਾ ਹੈ ਜਿਸ ਨੇ ਮੇਰੇ ਜੀਵਨ ਨੂੰ ਡੂੰਘਾ ਕੀਤਾ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਆਪ ਨੂੰ ਦਿਨ ਵਿੱਚ ਇੱਕ ਘੰਟਾ ਕੱਢ ਕੇ ਸਿਹਤ ਦੀ ਤੰਦਰੁਸਤੀ ਲਈ ਭੰਗੜਾ ਐਰੋਬਿਕਸ ਕਰਨਾ ਚਾਹੀਦਾ ਜਿਸ ਨਾਲ ਮਾਨਸਿਕ ਸਰੀਰਕ ਤੌਰ 'ਤੇ ਵਿਕਾਸ ਹੁੰਦਾ ਹੈ